ਰੂਪਨਗਰ ਇੱਕ ਪੁਰਾਣਾ ਜ਼ਿਲ੍ਹਾ ਹੈਗਾ ਇਸ ਜ਼ਿਲ੍ਹੇ ਵਿੱਚ ਲੋਕਾਂ ਦੇ ਆਪਣੇ ਕੋਠੀਆਂ ਹੈਗੀਆਂ ਇੱਥੇ ਬਹੁ ਮੰਜਲੀ ਇਮਾਰਤਾਂ ਦਾ ਪਤਨ ਹਜੇ ਸ਼ੁਰੂ ਨਹੀਂ ਹੋਇਆ ਜ਼ਿਆਦਾਤਰ ਛੋਟੇ ਛੋਟੇ ਮਕਾਨ ਬਣੇ ਹੋਏ ਹੈਗੇ ਮਕਾਨਾਂ ਦੇ ਇਲਾਵਾ ਇੱਥੇ ਹੋਸਟਲ ਗੈਸਟ ਹਾਊਸ ਅਤੇ ਹੋਟਲ ਵੀ ਹੈਗੇ ਇਸ ਤੋਂ ਇਲਾਵਾ ਰਿਹਾਇਸ਼ ਵਾਸਤੇ ਲੋਕ ਗੁਰਦੁਆਰਾ ਸਾਹਿਬ ਵੀ ਜਾ ਸਕਦੇ ਹੈਗੇ ਜਿਹੜੇ ਬੱਚੇ ਇੱਥੋਂ ਬਾਹਰੋਂ ਪੜਨ ਵਾਸਤੇ ਆਉਂਦੇ ਨੇ ਉਹ ਕਿਰਾਏ 'ਤੇ ਕਮਰਾ ਲੈ ਸਕਦੇ ਨੇ ਕਮਰਾ ਤਿੰਨ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਮਿਲ ਜਾਂਦਾ ਹੈ ਅਤੇ ਜੇਕਰ ਬੰਦੇ ਨੇ ਰੋਟੀ ਪਾਣੀ ਵੀ ਨਾਲ ਖਾਣਾ ਹੋਏ ਤਾਂ ਉਹਦੀ ਵਿਵਸਥਾ ਇੱਥੇ ਹੈਗੀ ਹਾਂ